ਸਥਾਨਕ ਖੇਡਾਂ ਅਤੇ ਮਨੋਰੰਜਕ ਗਤੀਵਿਧੀਆਂ ਖੇਤਰ ਦੇ ਸੱਭਿਆਚਾਰਕ ਅਤੇ ਸਮਾਜ ਮੁਖੀ ਸੁਭਾਅ ਨੂੰ ਦਰਸਾਉਂਦੀਆਂ ਹਨ ਜਿਲਾ ਬਰਨਾਲਾ ਦੀਆਂ ਕੁਝ ਪ੍ਰਮੁੱਖ ਗਤੀਵਿਧੀਆਂ ਇਸ ਪ੍ਰਕਾਰ ਹਨ ਰਵਾਇਤੀ ਖੇਡਾਂ ਕਬੱਡੀ ਇਹ ਰਿਵਾਇਤੀ ਟੀਮ ਖੇਡ ਪੰਜਾਬ ਅਤੇ ਬਰਨਾਲਾ ਵਿੱਚ ਬਹੁਤ ਮਸ਼ਹੂਰ ਹੈ ਜੋ ਤਾਕਤ ਚੁਸਤੀ ਅਤੇ ਰਣਨੀਤੀ ਦਾ ਪ੍ਰਦਰਸ਼ਨ ਕਰਦੀ ਹੈ ਕੁਸ਼ਤੀ ਰਿਵਾਇਤੀ ਕੁਸ਼ਤੀ ਇੱਕ ਸਤਿਕਾਰਯੋਗ ਖੇਡ ਹੈ ਜਿਸ ਵਿੱਚ ਸਥਾਨਕ ਮੁਕਾਬਲੇ ਅਤੇ ਟੂਰਨਾਮੈਂਟ ਅਕਸਰ ਹੁੰਦੇ ਹਨ ਕ੍ਰਿਕਟ ਸਥਾਨਕ ਟੂਰਨਾਮੈਂਟ ਵੱਖ ਵੱਖ ਜ਼ਿਲਾ ਅਤੇ ਰਾਜ ਪੱਧਰੀ ਟੂਰਨਾਮੈਂਟਾਂ ਵਿੱਚ ਭਾਗ ਲੈਣ ਵਾਲੀਆਂ ਸਥਾਨਕ ਟੀਮਾਂ ਅਤੇ ਕਲੱਬਾਂ ਦੇ ਨਾਲ ਕ੍ਰਿਕਟ ਦੀ ਵਿਆਪਕ ਪ੍ਰਸਿੱਧੀ ਹੈ ਫੀਲਡ ਹਾਕੀ ਕਮਿਊਨਿਟੀ ਅਤੇ ਸਕੂਲ ਟੀਮਾਂ ਫੀਲਡ ਹਾਕੀ ਵਿੱਚ ਇੱਕ ਮਹੱਤਵਪੂਰਨ ਹੇਠ ਲਿਖੇ ਹਨ ਜਿਸ ਵਿੱਚ ਸਥਾਨਕ ਟੀਮਾਂ ਅਤੇ ਸਕੂਲ ਸਰਗਰਮੀ ਨਾਲ ਟੂਰਨਾਮੈਂਟਾਂ ਅਤੇ ਲੀਗਾ ਵਿੱਚ ਹਿੱਸਾ ਲੈ ਰਹੇ ਹਨ ਵਾਲੀਬਾਲ ਕਮਿਊਨਿਟੀ ਮੈਚ ਵਾਲੀਬਾਲ ਇੱਕ ਪ੍ਰਸਿੱਧ ਮਨੋਰੰਜਕ ਗਤੀਵਿਧੀ ਹੈ ਜਿਸ ਵਿੱਚ ਕਮਿਊਨਿਟੀ ਖੇਡਾਂ ਅਤੇ ਟੂਰਨਾਮੈਂਟ ਇੱਕ ਆਮ ਦ੍ਰਿਸ਼ ਹਨ ਐਥਲੈਟਿਕਸ ਟਰੈਕ ਅਤੇ ਫੀਲਡ ਇਵੈਂਟਸ ਸਥਾਨਕ ਸਕੂਲ ਅਤੇ ਕਾਲਜ ਅਕਸਰ ਐਥਲੈਟਿਕ ਇਵੈਂਟਾਂ ਦਾ ਆਯੋਜਨ ਕਰਦੇ ਹਨ ਖੇਡਾਂ ਨੂੰ ਉਤਸ਼ਾਹਿਤ ਕਰਦੇ ਹਨ ਜਿਵੇਂ ਕਿ ਦੌੜ ਲੰਬੀ ਛਾਲ ਅਤੇ ਉੱਚੀ ਛਾਲ ਸੱਭਿਆਚਾਰਕ ਤਿਉਹਾਰ ਅਤੇ ਸਮਾਗਮ ਮੇਲਾ ਵੱਖ ਵੱਖ ਮੇਲੇ ਅਤੇ ਤਿਉਹਾਰ ਰਵਾਇਤੀ ਖੇਡਾਂ ਅਤੇ ਖੇਡਾਂ ਨੂੰ ਪੇਸ਼ ਕਰਦੇ ਹਨ ਜੋ ਮੰਨੋਰੰਜਕ ਅਤੇ ਸੱਭਿਆਚਾਰਕ ਸੰਸ਼ੋਧਨ ਪ੍ਰਦਾਨ ਕਰਦੇ ਹਨ ਸਥਾਨਕ ਜਸ਼ਨ ਲੋਹੜੀ ਅਤੇ ਵਿਸਾਖੀ ਵਰਗੇ ਤਿਉਹਾਰਾਂ ਵਿੱਚ ਅਕਸਰ ਲੋਕ ਨਾਚ ਅਤੇ ਖੇਡ ਮੁਕਾਬਲੇ ਸ਼ਾਮਿਲ ਹੁੰਦੇ ਹਨ ਇਹ ਗਤੀਵਿਧੀਆਂ ਬਰਨਾਲਾ ਵਿੱਚ ਰਵਾਇਤੀ ਅਤੇ ਆਧੁਨਿਕ ਖੇਡਾਂ ਦੇ ਸੁਮੇਲ ਨੂੰ ਉਜਾਗਰ ਕਰਦੀਆਂ ਹਨ ਜਿਸ ਨਾਲ ਭਾਈਚਾਰਕ ਸ਼ਮੂਲੀਅਤ ਅਤੇ ਵਿਅਕਤੀਗਤ ਤੰਦਰੁਸਤੀ ਦੋਵਾਂ ਨੂੰ ਉਤਸਾਹਿਤ ਕੀਤਾ ਜਾਂਦਾ ਹੈ